ਹੈਲੋ ਸਰ ਸਰ ਐਮਾਜੋਨ ਤੋਂ ਬੋਲਦੇ ਪਏ ਜੇ ਸਰ ਮੈਂ ਨਾ ਐਮਾਜੋਨ ਤੋਂ ਆਪਣੇ ਲਈ ਇੱਕ ਪ੍ਰੋਡਕਟ ਖਰੀਦਿਆ ਸੀਗਾ ਸੂਟ ਆਪਣਾ ਸੂਟ ਖਰੀਦਿਆ ਸੀ ਉਹ ਸੂਟ ਦੀ ਫਿਟਿੰਗ ਬਹੁਤ ਹੀ ਜ਼ਿਆਦਾ ਵਧੀਆ ਆਈ ਆ ਅਤੇ ਉਹਦਾ ਕਲਰ ਵੀ ਬਹੁਤ ਵਧੀਆ ਰਿਹਾ ਵੋਸ਼ ਕਰਨ 'ਤੇ ਵੀ ਕਲਰ ਉਹਦਾ ਨਹੀਂ ਉੱਡਿਆ ਇੰਨਾ ਯੂਨੀਕ ਕਲਰ ਸੀਗਾ ਉਹ ਕਾਫੀ ਮੈਂ ਲੱਭ ਰਹੀ ਸੀ ਮਾਰਕੀਟ ਵਿੱਚ ਵੀ ਲੱਭ ਰਹੀ ਸੀ ਅਤੇ ਕਾਫੀ ਦੁਕਾਨਾਂ 'ਤੇ ਦੇਖਿਆ ਪਰ ਉਹ ਮੈਨੂੰ ਕਿਤੋਂ ਨਹੀਂ ਲੱਭ ਰਿਹਾ ਸੀ ਪਰ ਜਦੋਂ ਮੈਂ ਤੁਹਾਡੀ ਸਾਈਟ ਖੋਲ੍ਹੀ ਨਾ ਇਹਦੇ ਵਿੱਚ ਮੈਂ ਡਰੈੱਸ ਫਾਇੰਡ ਕਰ ਰਹੀ ਸੀ ਅਚਾਨਕ ਹੀ ਇਹ ਕਲਰ ਕਲਰ ਸਾਹਮਣੇ ਆ ਗਿਆ ਫਿਰ ਮੈਨੂੰ ਡਰੈੱਸ ਬਹੁਤ ਪਸੰਦ ਆਈ ਅਤੇ ਮੈਂ ਇਹਨੂੰ ਕਾਫੀ ਟਾਈਮ ਪਾ ਵੀ ਲਿਆ ਵਾ ਪਰ ਬੜੀ ਵਧੀਆ ਇਹਦੇ ਵਿੱਚ ਫਿਟਿੰਗ ਮੇਨ ਗੱਲ ਬਹੁਤ ਵਧੀਆ ਹੈ ਕਿ ਫਿਟਿੰਗ ਬਹੁਤ ਸੋਹਣੀ ਇਹਦੀ ਆਈ ਆ ਅਤੇ ਇਹ ਤੋਂ ਚਲੋ ਹੋਰ ਵੀ ਵਧੀਆ ਪ੍ਰੋਡਕਟ ਬਣਾਉਂਦੇ ਰਹੋ ਅਤੇ ਗੋਡ ਬਲੈਸ ਯੂ